ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਸ਼ੁਰੂ ਤੋਂ ਹੀ ਪੰਜਾਬ ਸਿੱਖਿਆ ਪ੍ਰਣਾਲੀ ਨਾਲ ਪੜ੍ਹਿਆ ਹਾਂ ਜੋ ਕਿ ਮੇਰੇ ਟੀਚਰ ਵੀ ਪੰਜਾਬ ਸਿੱਖਿਆ ਪ੍ਰਣਾਲੀ ਰਾਹੀਂ ਪੜ੍ਹੇ ਹਨ ਜੋ ਕਿ ਬਹੁਤ ਪੜ੍ਹੇ ਲਿਖੇ ਅਤੇ ਅੱਛੇ ਵਿਦਵਾਨ ਟੀਚਰ ਹਨ ਜਿਨ੍ਹਾਂ ਨੇ ਕਿ ਮੈਨੂੰ ਪੜ੍ਹਾਇਆ ਹੈ ਪੰਜਾਬ ਸਿੱਖਿਆ ਪ੍ਰਣਾਲੀ ਨਾਲ ਜੋ ਕਿ ਇੱਕ ਬਹੁਤ ਵਧੀਆ ਸਿੱਖਿਆ ਪ੍ਰਣਾਲੀ ਹੈ ਜਿਹਦੇ ਰਾਹੀਂ ਟੀਚਰ ਅਸਾਨੀ ਨਾਲ ਬੱਚਿਆਂ ਦੇ ਨਾਲ ਕਮਿਉਨੀਕੇਟ ਕਰ ਪਾਉਂਦੇ ਹਨ ਅਤੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਪਾਉਂਦੇ ਹਨ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਬੱਚਿਆਂ ਨੂੰ ਸਿਖਾਇਆ ਵਧੀਆ ਤਰੀਕੇ ਨਾਲ ਜਾਂਦਾ ਹੈ ਜਿਹਦੀ ਵਜ੍ਹਾ ਨਾਲ ਕਿ ਬੱਚੇ ਬਹੁਤ ਅੱਛੇ ਤਰੀਕੇ ਨਾਲ ਪੜ੍ਹ ਪਾਉਂਦੇ ਹਨ ਅਤੇ ਅੱਗੇ ਕੁੱਛ ਵਧੀਆ ਕਰ ਪਾਉਂਦੇ ਹਨ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਉਸ ਤੋਂ ਇਲਾਵਾ ਕਈ ਹੁਣ ਹੋਰ ਨਵੀਆਂ ਚੀਜ਼ਾਂ ਵੀ ਆ ਗਈਆਂ ਹਨ ਜਿਹਦੇ ਵਿੱਚ ਕਿ ਵੈਲਕਮ ਲਾਈਫ ਵਰਗੇ ਨਵੇਂ ਸਬਜੈਕਟ ਜਿਹੜੇ ਕਿ ਬੱਚਿਆਂ ਨੂੰ ਜ਼ਿੰਦਗੀ ਬਾਰੇ ਵੀ ਦੱਸ ਰਹੇ ਹਨ ਉਸ ਤੋਂ ਇਲਾਵਾ ਟੀਚਰ ਵੀ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਅੱਛੇ ਹੁੰਦੇ ਹਨ ਹੋਰ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਜਿਹੜੀਆਂ ਬੁੱਕਾਂ ਹਨ ਉਹ ਵੀ ਬਹੁਤ ਵਧੀਆ ਹਨ ਉਹਨਾਂ ਵਿੱਚ ਪੁਰਾਣੇ ਪੁਰਾਣੇ ਕਵੀਆਂ ਦੀਆਂ ਕਹਾਣੀਆਂ ਅਤੇ ਹੋਰ ਵੀ ਨਵੇਂ ਨਵੇਂ ਜਿਹੜੇ ਖੁਦ ਨਵੀਆਂ ਨਵੀਆਂ ਕਿਤਾਬਾਂ ਆਉਂਆਂ ਹਨ ਉਹਨਾਂ ਤੋਂ ਵੀ ਕਹਾਣੀਆਂ ਲਈਆਂ ਗਈਆਂ ਹਨ ਹੋਰ ਮੈਂ ਖੁਦ ਜਦੋਂ ਪੰਜਾਬ ਸਿੱਖਿਆ ਪ੍ਰਣਾਲੀ ਨਾਲ ਪੜ੍ਹਦਾ ਰਿਹਾ ਹਾਂ ਤਾਂ ਮੈਨੂੰ ਬਹੁਤ ਅੰਨਦ ਆਉਂਦਾ ਰਿਹਾ ਹੈ ਉਹਨਾਂ ਦੀ ਬੁੱਕਾਂ ਪੜ੍ਹ ਕੇ ਅਤੇ ਹੋਰ ਵੀ ਨਵੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਕਰਕੇ ਅੱਜ ਕੱਲ੍ਹ ਤਾਂ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਖੇਡਾਂ ਨੂੰ ਵੀ ਬਹੁਤ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਹਰ ਕਲਾਸ ਵਿੱਚੋਂ ਸਪੈਸ਼ਲੀ ਬੱਚੇ ਚੁੱਕੇ ਜਾਂਦੇ ਹਨ ਖੇਡਾਂ ਵਿੱਚ ਭੇਜਣ ਲਈ ਜਿਹਦੀ ਵਜ੍ਹਾ ਨਾਲ ਕਿ ਖੇਡਾਂ ਦਾ ਵੀ ਬਹੁਤ ਵਿਕਾਸ ਹੋ ਰਿਹਾ ਹੈ ਉਸ ਤੋਂ ਇਲਾਵਾ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਜਿੰਨੇ ਵੀ ਬੱਚੇ ਹੁੰਦੇ ਹਨ ਉਹ ਕਾਫੀ ਹੱਦ ਤੱਕ ਸਕਸੈਸਫੁੱਲ ਹੋ ਜਾਂਦੇ ਹਨ ਆਪਣੇ ਕਰੀਅਰ ਵਿੱਚ ਅਤੇ ਦੇਸ਼ ਦਾ ਵੀ ਨਾਮ ਰੋਸ਼ਨ ਕਰਦੇ ਹਨ ਲੇਕਿਨ ਦੇਖਿਆ ਜਾਏ ਤਾਂ ਪੰਜਾਬ ਸਿੱਖਿਆ ਪ੍ਰਣਾਲੀ ਵਿੱਚ ਪੜ੍ਹਾਇਆ ਬਹੁਤ ਜਾਂਦਾ ਹੈ ਕਿ ਲੇਕਿਨ ਕਰਵਾਇਆ ਘੱਟ ਜਾਂਦਾ ਹੈ ਪੰਜਾਬ ਸਿੱਖਿਆ ਪ੍ਰਣਾਲੀ ਰਾਹੀਂ ਬੱਚਿਆਂ ਨੂੰ ਉਹ ਪੜ੍ਹਾਉਂਦੇ ਹਨ ਪਰ ਉਹਨਾਂ ਨੂੰ ਨਵੀਆਂ ਚੀਜ਼ਾਂ ਹੱਥੀਂ ਨਹੀਂ ਸਿਖਾਉਂਦੇ ਹਨ ਜਿਹਦੀ ਵਜ੍ਹਾ ਨਾਲ ਕਿ ਬੱਚੇ ਬਾਹਰ ਜਾ ਕੇ ਸਮਾਜ ਵਿੱਚ ਥੋੜ੍ਹੇ ਕਮਜ਼ੋਰ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਹੱਥਾਂ ਨਾਲ ਕੰਮ ਕਰਨਾ ਨਹੀਂ ਆਉਂਦਾ ਜੋ ਕਿ ਇੱਕ ਬਹੁਤ ਬੁਰੀ ਗੱਲ ਹੈ ਲੇਕਿਨ ਜਿੱਦਾਂ ਜਿੱਦਾਂ ਕਿ ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਹੈ ਇਹ ਕਮੀ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ ਇਸ ਕਰਕੇ ਪੰਜਾਬ ਸਿੱਖਿਆ ਪ੍ਰਣਾਲੀ ਇੱਕ ਬਹੁਤ ਹੀ ਵਧੀਆ ਪ੍ਰਣਾਲੀ ਹੈ ਅਤੇ ਇਹ ਇੱਕ ਹੋਰ ਗੱਲ ਇਹਦੇ ਵਿੱਚ ਪੰਜਾਬੀ ਨੂੰ ਬਹੁਤ ਅੱਛੇ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਪੰਜਾਬੀ ਨੂੰ ਮੁੱਖ ਤੌਰ 'ਤੇ ਪੜ੍ਹਾਇਆ ਜਾਂਦਾ ਹੈ ਇੱਕ ਪੰਜਾਬੀ ਸਭ ਤੋਂ ਜ਼ਰੂਰੀ ਸਬਜੈਕਟ ਨਾਲ ਦੱਸਿਆ ਜਾਂਦਾ ਹੈ ਜਿਹਦੀ ਵਜ੍ਹਾ ਨਾਲ ਕਿ ਜਿਹੜੇ ਵੀ ਬੱਚੇ ਪੰਜਾਬੀ ਸਿੱਖਿਆ ਪ੍ਰਣਾਲੀ ਨਾਲ ਪੜ੍ਹਦੇ ਹਨ ਪੰਜਾਬੀ ਨੂੰ ਆਪਣੀ ਮਾਤਰ ਭਾਸ਼ਾ ਅੱਛੇ ਤਰੀਕੇ ਨਾਲ ਪੜ੍ਹਦੇ ਹਨ ਜਿਹਦੀ ਵਜ੍ਹਾ ਨਾਲ ਕਿ ਬੱਚੇ ਪੰਜਾਬੀ ਨਾਲ ਵੀ ਬਹੁਤ ਅੱਛੇ ਤਰੀਕੇ ਨਾਲ ਜੁੜ ਜਾਂਦੇ ਹਨ ਇਸ ਕਰਕੇ ਪੰਜਾਬੀ ਸਿੱਖਿਆ ਪ੍ਰਣਾਲੀ ਪੰਜਾਬ ਦੇ ਲਈ ਅਤੇ ਭਾਰਤ ਦੇ ਲਈ ਵੀ ਬਹੁਤ ਹੀ ਵਧੀਆ ਸਿੱਖਿਆ ਪ੍ਰਣਾਲੀ ਹੈ